ਮੈਂ ਪਕਵਾਨ ਮੂੰਗੀ ਮਸਰੀ ਦਾਲ ਰੋਟੀ ਸਬਜ਼ੀ ਚਾਹ ਇਹ ਸਭ ਬਣਾ ਲੈਂਦਾ ਹਾਂ ਇਹਨਾਂ ਵਿੱਚ ਮੂੰਗੀ ਮਸਰੀ ਦੀ ਦਾਲ ਦੀ ਰੈਸੇਪੀ ਸਭ ਤੋਂ ਪਹਿਲਾਂ ਮੂੰਗੀ ਮਸਰੀ ਦੀ ਦਾਲ ਨੂੰ ਸਾਫ਼ ਕਰੋ ਅਤੇ ਉਸ ਨੂੰ ਪਾਣੀ ਵਿੱਚ ਭਿਗੋ ਦਿਓ ਇਸ ਤੋਂ ਬਾਅਦ ਥੋੜ੍ਹਾ ਜਿਹਾ ਫਰਾਈਪੈਨ 'ਚ ਘਿਉ ਪਾਓ ਅਤੇ ਜ਼ੀਰੇ ਦਾ ਤੜਕਾ ਲਗਾਓ ਤੜਕਾ ਲਗਾਉਣ ਤੋਂ ਬਾਅਦ ਉਹਦੇ ਵਿੱਚ ਪਿਆਜ਼ ਲੱਸਣ ਅਦਰਕ ਪਾ ਦਿਓ ਜਦੋਂ ਤੜਕਾ ਪੱਕ ਜਾਵੇ ਫਿਰ ਪਿਆਜ਼ ਟਮਾਟਰ ਪਾਓ ਟਮਾਟਰ ਪਾਉਣ ਤੋਂ ਬਾਅਦ ਮੂੰਗੀ ਦੀ ਦਾਲ ਧੋਈ ਵੀ ਜਿਹੜੀ ਉਹ ਪਾਓ ਇਹ ਤੋਂ ਬਾਅਦ ਪੰਦਰਾਂ ਮਿੰਟ ਦੇ ਵਿੱਚ ਕੁੱਕਰ ਵਿੱਚ ਪਾ ਕੇ ਬੰਦ ਕਰ ਦਿਓ ਪੰਦਰਾਂ ਮਿੰਟ 'ਚ ਦਾਲ ਬਿਲਕੁਲ ਬਣ ਕੇ ਤਿਆਰ ਹੋ ਜਾਵੇਗੀ